ਸਾਡੇ ਦੇਸ਼ ਦੇ ਵਿੱਚ ਪ੍ਰਾਈਵੇਟ ਹੋਸਪਿਟਲਜ਼ ਆ ਜਿਹੜੇ ਉਹ ਜ਼ਿਆਦਾ ਖੁੱਲੇ ਹੋਏ ਆ ਅਤੇ ਸਰਕਾਰੀ ਹਸਪਤਾਲ ਘੱਟ ਪ੍ਰਾਈਵੇਟ ਹੋਸਪਿਟਲਜ਼ ਦੇ ਵਿੱਚ ਜਿਹੜੇ ਨੇ ਮਰੀਜ਼ ਆ ਉਹ ਇੰਨਾ ਪੈਸਾ ਖਰਚ ਨਹੀਂ ਕਰ ਸਕਦੇ ਸਰਕਾਰੀ ਸਹੂਲਤਾਂ ਏ ਆ ਜੋ ਸਰਕਾਰ ਨੂੰ ਜ਼ਿਆਦਾ ਦੇਣੀਆਂ ਚਾਹੀਦੀਆਂ ਏ ਆ ਜਿਵੇਂ ਕਿ ਔਕਸੀਜਨ ਸਿਲੰਡਰ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਉਹਨਾਂ ਦੀ ਘਾਟ ਹੁੰਦੀ ਆ ਅਤੇ ਉਹਨਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਅਤੇ ਐਮਰਜੈਂਸੀ ਸਟਾਫ ਹੈ ਜਿਹੜਾ ਉਹਨੂੰ ਪੂਰਾ ਕਰਨਾ ਚਾਹੀਦਾ ਕਿ ਐਮਰਜੈਂਸੀ ਦੇ ਵਿੱਚ ਜਦੋਂ ਮਰੀਜ਼ ਨੂੰ ਜ਼ਰੂਰਤ ਪਵੇ ਤਾਂ ਉਹ ਉਸ ਟਾਈਮ ਡੋਕਟਰ ਹੈ ਜੋ ਉਹ ਉਥੇ ਹਸਪਤਾਲ ਦੇ ਵਿੱਚ ਹੋਵੇ ਅਤੇ ਐਬੂਲੈਂਸਾਂ ਦੀ ਸਹੂਲਤ ਨੂੰ ਵਧਾਉਣਾ ਚਾਹੀਦਾ ਤਾਂ ਕਿ ਟਾਈਮ ਸਿਰ ਐਬੂਲੈਂਸ ਹੈ ਜੋ ਉਹ ਮਰੀਜ਼ ਦੇ ਕੋਲ ਪਹੁੰਚ ਸਕੇ ਕੋਵਿਡ ਦੇ ਵਿੱਚ ਕੋਵਿਡ ਮਹਾਂਮਾਰੀ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਲਈ ਹੈ ਅਤੇ ਕੋਵਿਡ ਦੇ ਵਿੱਚ ਬਹੁਤ ਸਾਰੀਆਂ ਡੈੱਥਾਂ ਹੋਈਆਂ ਏ ਆ ਅਤੇ ਲੋਕਾਂ ਨੇ ਸਾਵਧਾਨੀਆਂ ਵੀ ਵਰਤੀਆਂ ਏ ਆ ਪਰ ਉਸ ਅਤੇ ਬਾਵਜੂਦ ਵੀ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਪਰ ਜਦੋਂ ਦੀ ਵੈਕਸੀਨੇਸ਼ਨ ਹੋਈ ਹੈ ਵੈਕਸੀਨੇਸ਼ਨ ਤੋਂ ਬਾਅਦ ਹੈ ਜੋ ਉਹ ਡੈੱਥਸ ਉਹ ਘੱਟ ਗਈਆਂ ਆ ਅਤੇ ਲੋਕਾਂ ਨੇ ਵੀ ਆਪਣੀ ਸਿਹਤ ਪ੍ਰਤੀ ਥੋੜ੍ਹਾ ਜਾਗਰੂਕ ਹੋ ਗਿਆ ਅਤੇ ਲੋਕ ਆਪਣੀ ਸਿਹਤ ਦਾ ਧਿਆਨ ਰੱਖ ਰਹੇ ਆ ਅਤੇ ਕੋਵਿਡ ਤੋਂ ਬਚਾਅ ਕਰ ਰਹੇ ਆ ਮਾਸਕ ਪਾ ਰਹੇ ਆ